ਪੰਜਾਬ ਦਾ ਸੱਭਿਆਚਾਰ ਬਾਕੀ ਦੇਸ਼ਾਂ ਨਾਲ਼ੋਂ ਕਾਫ਼ੀ ਵੱਖਰਾ ਏ ਇਹਦੇ ਕਈ ਕਾਰਨ ਨੇ ਵੱਖਰੇ ਹੋਣ ਦੇ ਇਹਦੀ ਜਿਹੜੀ ਜੌਗ੍ਰਾਫ਼ੀਕਲ ਸਥਿਤੀ ਹੈ ਭੂਗੋਲਿਕ ਇਹਦੀ ਹੈਗੀ ਕੰਡੀਸ਼ਨ ਉਹ ਵੀ ਇੱਥੇ ਕਰਦੀ ਹੈ ਕਿਉਂਕਿ ਜਿਹੜਾ ਪੰਜਾਬ ਦੀ ਲੋਕੇਸ਼ਨ ਆ ਇਹਦੇ ਉੱਪਰ ਪਹਾੜ ਨੇ ਇੱਕ ਪਾਸੇ ਮੈਦਾਨੀ ਇਲਾਕਾ ਆ ਗਿਆ ਠੀਕ ਹੈ ਤਾਂ ਉਸ ਤਰੀਕੇ ਨਾਲ਼ ਉਹ ਵੀ ਜਿਹੜਾ ਇੱਥੋਂ ਦੇ ਕਲਚਰ ਡਿਵੈਲਪ ਕੀਤਾ ਹੈਗਾ ਇੱਥੇ ਮੌਸਮਾਂ ਦੀ ਗੱਲ ਕਰੀਏ ਤਾਂ ਗਰਮੀ ਸਰਦੀ ਹਰ ਇੱਕ ਤਰ੍ਹਾਂ ਦਾ ਮੌਸਮ ਪਾਇਆ ਜਾਂਦਾ ਹੈਗਾ ਤਾਂ ਉਹ ਮੌਸਮ ਜਿਹੜਾ ਹੈ ਇੱਥੋਂ ਦੇ ਲੋਕਾਂ ਦੇ ਸੁਭਾਅ ਵਿੱਚ ਰਚਿਆ ਹੋਇਆ ਇੱਥੋਂ ਦੇ ਲੋਕਾਂ ਦਾ ਸੁਭਾਅ ਵਿੱਚ ਜਿਹੜਾ ਹੈ ਗਰਮੀ ਸਰਦੀ ਦੇ ਅਕੋਡਿੰਗ ਸੱਭਿਆਚਾਰ ਦੇ ਵਿੱਚ ਉਹ ਰੱਚ ਗਿਆ ਇਹਨਾਂ ਦੇ ਪਹਿਰਾਵਿਆਂ ਵਿੱਚ ਰਚਿਆ ਹੋਇਆ ਹੈਗਾ ਇਹਨਾਂ ਦੇ ਪਹਿਰਾਵੇ ਉਸ ਤਰੀਕੇ ਦੇ ਕ੍ਰੀਏਟ ਹੋਏ ਵੇ ਨੇ ਉਸ ਤਰੀਕੇ ਦੇ ਪਹਿਰਾਵੇ ਵੀ ਬਣੇ ਹੋਏ ਨੇ ਤਾਂ ਇਹਨਾਂ ਦੇ ਸੱਭਿਆਚਾਰ ਦੇ ਵਿੱਚ ਪਹਿਰਾਵਾ ਇਹਨਾਂ ਦਾ ਖਾਣ ਪੀਣ ਇਹਨਾਂ ਦਾ ਬੋਲਣ ਇਹਨਾਂ ਦੇ ਹਾਸੇ ਖੇਡੇ ਰੋਸੇ ਸਾਰਾ ਕੁਛ ਜਿਹੜਾ ਹੈ ਉਹ ਸੱਭਿਆਚਾਰ ਦਾ ਹਿੱਸਾ ਹੀ ਨੇ ਅਤੇ ਬਾਕੀ ਜਿਹੜਾ ਹੈ ਕਲਚਰਸ ਨੇ ਵੱਖੋ ਵੱਖਰੇ ਦੇਸ਼ ਹਨ ਉਹਨਾਂ ਨਾਲੋਂ ਇਹ ਕਾਫ਼ੀ ਵੱਖਰਾ ਹੈਗਾ ਜੇ ਹੁਣ ਦੀ ਗੱਲ ਕਰੀਏ ਅਤੇ ਜਿਵੇਂ ਕਿ ਹੁਣ ਜਿਹੜਾ ਹੈ ਪੋਹ ਦਾ ਮਹੀਨਾ ਚੱਲ ਰਿਹਾ ਦਸੰਬਰ ਦੇ ਵਿੱਚ ਇਸ ਸਮੇਂ ਜਿਹੜਾ ਹੈ ਇੱਥੇ ਸ਼ਹੀਦੀ ਦਿਨ ਚੱਲ ਰਹੇ ਨੇ ਤਾਂ ਵੱਡੇ ਦਿਨ ਵੀ ਇਹਨਾਂ ਨੂੰ ਕਹਿ ਦਿੰਦੇ ਨੇ ਇਸ ਸਮੇਂ ਜਿਹੜੇ ਹੈਗੇ ਨੇ ਪੋਹ ਦੇ ਮਹੀਨੇ ਵਿੱਚ ਛੋਟੇ ਸਾਹਿਬਜ਼ਾਦੇ ਸ਼ਹੀਦ ਉਹ ਕੀਤੇ ਗਏ ਸੀ ਵਜ਼ੀਰ ਖ਼ਾਨ ਵੱਲੋਂ ਉਸ ਸਮੇਂ ਤੋਂ ਲੈ ਕੇ ਇਹਨਾਂ ਨੂੰ ਵੱਡੇ ਦਿਨਾਂ ਦੇ ਰੂਪ ਦੇ ਵਿੱਚ ਯਾਦ ਕੀਤਾ ਜਾਂਦਾ ਗਾ